ਮੈਂ ਸ਼ਹਿਰੀ ਖੇਤਰ ਅਤੇ ਪੇਂਡੂ ਖੇਤਰ ਵਿੱਚ ਸਿਹਤ ਸੰਭਾਲ ਦੇ ਬਾਰੇ ਬੋਲਣਾ ਚਾਹੁੰਦਾ ਹਾਂ ਕਿ ਸਿਹਤ ਬਾਰੇ ਬੋਲਣ ਦੀ ਤੁਲਨਾ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਕਿ ਪਿੰ ਸ਼ਹਿਰਾਂ ਵਿੱਚ ਪ੍ਰਾਈਵੇਟ ਹਸਪਤਾਲ ਹੋਣ ਦੇ ਕਾਰਨ ਕੋਈ ਵੀ ਮਰੀਜ਼ ਨੂੰ ਕੋਈ ਜ਼ਰੂਰ ਜ਼ਰੂਰੀ ਜ਼ਰੂਰੀ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਉੱਥੇ ਐਬੂਲੈਂਸ ਦੀ ਸਹੂਲਤ ਜ਼ਿਆਦਾ ਹੋਣ ਕਾਰਨ ਉਸਦਾ ਇਲਾਜ ਛੇਤੀ ਕੀਤਾ ਜਾਂਦਾ ਹੈ ਅਤੇ ਉਸ ਨੂੰ ਜਲਦੀ ਤੋਂ ਜਲਦੀ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਹੈ ਅਤੇ ਉਸ ਮਰੀਜ਼ ਦਾ ਚੰਗੀ ਤਰ੍ਹਾਂ ਟ੍ਰੀਟਮੈਂਟ ਕੀਤਾ ਜਾਂਦਾ ਹੈ ਇਸ ਲਈ ਸ਼ਹਿਰੀ ਖੇਤਰ ਵਿੱਚ ਮੁਸ਼ਕਲ ਬਹੁਤ ਹੀ ਘੱਟ ਆਉਂਦੀ ਹੈ ਅਤੇ ਇਸ ਨਾਲ ਅਤੇ ਪੇਂਡੂ ਖੇਤਰ ਵਿੱਚ ਇਸ ਦੀਆਂ ਮੁਸ਼ਕਿਲਾਂ ਬਹੁਤ ਹੀ ਜ਼ਿਆਦਾ ਵੱਧ ਜਾਂਦੀਆਂ ਹਨ ਜਿਵੇਂ ਕਿ ਪੇਂ ਸ਼ਹਿਰ ਤੋਂ ਪੇਂਡੂ ਖੇਤਰ ਬਹੁਤ ਹੀ ਜ਼ਿਆਦਾ ਦੂਰ ਪੈ ਜਾਂਦਾ ਹੈ ਜਿਵੇਂ ਕਿ ਪੇਂਡੂ ਖੇਤਰ ਵਿੱਚ ਤਾਂ ਕੋਈ ਵੀ ਪ੍ਰਾਈਵੇਟ ਹਸਪਤਾਲ ਨਹੀਂ ਹੁੰਦਾ ਅਤੇ ਸ਼ਹਿਰਾਂ ਵਿੱਚ ਤਾਂ ਪ੍ਰਾਈਵੇਟ ਹਸਪਤਾਲ ਵੀ ਹੁੰਦੇ ਹਨ ਅਤੇ ਉਸ ਨਾਲ ਟਾਈਮ ਜ਼ਿਆਦਾ ਲੱਗਣ ਕਾਰਨ ਮਰੀਜ਼ ਦੀ ਕੋਈ ਵੀ ਰੋਗ ਜ਼ਿਆਦਾ ਵੱਧ ਜਾਂਦਾ ਹੈ ਅਤੇ ਪੇਂਡੂ ਖੇਤਰਾਂ ਵਿੱਚ ਕੋਈ ਮੈਡੀਕਲ ਸਟੋਰ ਹੁੰਦੇ ਹਨ ਅਤੇ ਉਹਨਾਂ ਤੋਂ ਵੀ ਦਵਾਈ ਡੇਟ ਟੱਪੀ ਵਾਲੀ ਮਿਲਦੀ ਹੈ ਜਾਂ ਕੋਈ ਹੋਰ ਕੋਈ ਬਹੁਤ ਹੀ ਚੰਗੀ ਪੇਂਡੂ ਖੇਤਰ ਵਿੱਚ ਸੰਭਾਲ ਨਹੀਂ ਹੁੰਦੀ ਕਿ ਸਿਹਤ ਦੀ ਬਸ ਇਸ ਨਾਲ ਇੱਕ ਸੰਭਾਲ ਜ਼ਰੂਰ ਰਹਿੰਦੀ ਹੈ ਕਿ ਸਾਨੂੰ ਇੱਥੇ ਹਵਾ ਬਹੁਤ ਹੀ ਵਧੀਆ ਮਿਲਦੀ ਹੈ ਅਤੇ ਸ਼ਹਿਰ ਵਿੱਚ ਸਾਨੂੰ ਪ੍ਰਦੂਸ਼ਣ ਵਾਲੀ ਹਵਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਬਸ ਮੈਂ ਇੰਨੀ ਤੁਲਨਾ ਕਰਨਾ ਚਾਹੁੰਦਾ ਹਾਂ ਧੰਨਵਾਦ